ਮੱਛੀਆਂ ਪਾਲਣ ਦੇ ਲਈ ਜਾਂ ਮੱਛੀਆਂ ਫੜਨ ਦੇ ਲਈ ਪਾਣੀ ਦਾ ਸਾਫ ਸੁਥਰਾ ਹੋਣਾ ਜ਼ਰੂਰੀ ਆ ਅਗਰ ਪਾਣੀ ਸਾਫ ਸੁਥਰਾ ਹੋਊਗਾ ਤਾਂ ਮੱਛੀਆਂ ਵੀ ਸਿਹਤਮੰਦ ਹੋਣਗੀਆਂ ਅਗਰ ਪਾਣੀ ਸਾਫ ਨਹੀਂ ਹੋਊਗਾ ਤਾਂ ਉਹਦੇ ਨਾਲ ਮੱਛੀਆਂ ਦੀ ਸਿਹਤ ਨ ਦੇ ਨਾਲ ਖਿਲਵਾੜ ਹੋਊਗਾ ਹੋ ਸਕਦਾ ਹੈ ਕਿ ਤੁਸੀਂ ਮੱਛੀ ਖਾਂਦੇ ਆ ਜਾਂ ਕੁਛ ਵੀ ਆ ਤਾਂ ਉਹਦੇ ਨਾਲ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਹੋ ਸਕਦਾ ਆ ਇਸ ਕਰਕੇ ਜੋ ਪ੍ਰਦੂਸ਼ਣ ਚੱਲ ਰਿਹਾ ਉਹਦੇ ਨਾਲ ਮੱਛੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ